ਹਾਂਜੀ ਮੇਰੀ ਕਾਫੀ ਗੇਮਾਂ ਹਾਂ ਜੋ ਮੈਨੂੰ ਪਸੰਦ ਲੱਗਦੀਆਂ ਲਾਈਕ ਫੁੱਟਬਾਲ ਹੋ ਗਈ ਕ੍ਰਿਕਟ ਹੋ ਗਈ ਬਾਸਕਿਟਬਾਲ ਬਟ ਮੇਰੀ ਫੇਵਰਟ ਕ੍ਰਿਕਟ ਹੈ ਕਿਉਂ ਕਿਉਂਕਿ ਮੈਂ ਆਈ ਥਿੰਕ ਇਹ ਜੈਂਟਲਮੈਨ ਗੇਮ ਹੈ ਅਤੇ ਮੈਂ ਸ਼ੁਰੂ ਤੋਂ ਲਾਈਕ ਕਰਦਾ ਜਦੋਂ ਮੈਂ ਸਕੂਲ ਸੀ ਤਾਂ ਮੈਂ ਸਕੂਲ ਵਿੱਚ ਵੀ ਕਾਫੀ ਕੰਪੀਟੀਸ਼ਨ ਪਾਰਟੀਸਪੇਟ ਕੀਤੇ ਅਤੇ ਕਈ ਪ੍ਰਾਈਜ਼ ਵੀ ਜਿੱਤੇ ਅਤੇ ਹੁਣ ਮੈਂ ਹੁਣ ਵੀ ਖੇਡਦਾ ਮੈਂ ਆਪਣੇ ਦੋਸਤਾਂ ਨਾਲ ਜਦੋਂ ਵੀਕਐਂਡ ਵਿੱਚ ਮੇਰੇ ਕੋਲ ਜ਼ਿਆਦਾ ਟਾਈਮ ਹੁੰਦਾ ਹੈ ਅਤੇ ਅਸੀਂ ਇੰਜੋਏ ਕਰਦੇ ਹੈ ਅਤੇ ਅਸੀਂ ਪਲੇਅਰ ਦਸ ਦਸ ਬਾਰਾਂ ਦੋਸਤ ਹੁੰਦੇ ਹੈ ਅਤੇ ਆਪਾਂ ਦੋ ਟੀਮਾਂ 'ਚ ਡੀਵਾਈਡ ਕਰ ਲੈਂਦੇ ਹੈ ਅਤੇ ਮੈਂ ਬੈਟਿੰਗ ਵੀ ਪਸੰਦ ਕਰਦਾ ਹੈ ਬੌਲਿੰਗ ਵੀ ਪਸੰਦ ਕਰਦਾ ਹੈ ਬਟ ਬੈਟਿੰਗ ਇਜ਼ ਮੇਰਾ ਫੇਵਰੇਟ ਪਾਰਟ ਹੈ ਅਤੇ ਅਸੀਂ ਇੰਜੋਏ ਕਰਦੇ ਹੈ ਸੰਡੇ ਨੂੰ ਮੋਸਟ ਓਫ ਟਾਈਮ ਅਤੇ ਇਸ ਤੋ ਇਲਾਵਾ ਮੈਂ ਆਪਣੀ ਇੰਡੀਆ ਟੀਮ ਨੂੰ ਵੀ ਚੇਅਰ ਕਰਦਾ ਹੈ ਜਦੋਂ ਵੀ ਲਾਈਵ ਮੈਚ ਆਉਂਦੇ ਹੈ ਤੇ ਹਮੇਸ਼ਾ ਮੈਂ ਦੇਖਦਾ ਹੈ ਮੈਂ ਸਕਿੱਪ ਨਹੀਂ ਕਰਦਾ ਮੈਚ ਬੀਕੌਜ਼ ਇਹ ਮੇਰੀ ਫੇਵਰੇਟ ਗੇਮ ਹੈ ਅਤੇ ਮੇਰਾ ਫੇਵਰੇਟ ਜੋ ਪਲੇਅਰ ਹੈ ਵਿਰਾਟ ਕੋਹਲੀ ਬੀਕੌਜ਼ ਹੀ ਇਜ਼ ਵੈਰੀ ਫੇਮਸ ਪਲੇਅਰ ਅਤੇ ਮੈਂ ਓਹਦੀ ਗੇਮ ਦੇਖਣਾ ਵੀ ਪਸੰਦ ਕਰਦਾ ਹੈ ਅਤੇ ਹੈ ਵੀ ਪੰਜਾਬ ਤੋਂ ਹੈ ਅਤੇ ਕਾਫੀ ਅੱਛੀ ਗੇਮ ਖੇਡਦਾ ਹੈ ਕਾਫੀ ਅੱਛੇ ਰਨ ਮਾਰੇ ਹੈ ਓਹਨੇ ਕਾਫੀ ਨੇਮ ਫੇਮ ਹੈ ਵਰਲਡ ਵਿੱਚ ਅਤੇ ਆਈ ਈਵਨ ਮੇਰੀ ਫੈਮਲੀ ਵੀ ਇੰਜੋਏ ਕਰਦੀ ਹੈ ਅਸੀਂ ਬੈਠ ਕੇ ਇੱਕਠਾ ਲਾਈਵ ਮੈਚ ਦੇਖਦੇ ਹੈ ਜਦੋਂ ਵੀ ਇੰਡੀਆ ਦਾ ਮੈਚ ਆ ਰਿਹਾ ਹੁੰਦਾ ਹੈ ਅਤੇ ਆਪਾਂ ਚੀਅਰ ਕਰਦੇ ਹੈ ਅਤੇ ਆਪਾਂ ਆਪਣੀ ਕੋਸ਼ਿਸ਼ ਕਰਦੇ ਹਾਂ ਵੀ ਹਾਂ ਆਪਣੀ ਟੀਮ ਜਿੱਤੇ ਇੰਡੀਆ ਟੀਮ ਜਿੱਤੇ